ਛੱਬੀ ਜਨਵਰੀ ਵੀਹ ਸੌ ਇੱਕੀ ਦਸ ਮਈ ਵੀਹ ਸੌ ਦਸ ਚਾਰ ਮਾਰਚ ਉੱਨੀ ਸੌ ਵੀਹ ਬਾਰ੍ਹਾਂ ਦਸੰਬਰ ਉੱਨੀ ਸੌ ਇਕਾਨਵੇਂ ਛੇ ਸਤੰਬਰ ਦੋ ਹਜ਼ਾਰ ਸੱਤ